ਹੈਲੋ ਹਾਂਜੀ ਅਸੀਂ ਜੀ ਫੋਰੈਸਟ ਡਿਪਾਰਟਮੈਂਟ ਤੋਂ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਛਾ ਠੀਕ ਹੈ ਵੇਖੋ ਆਪਾਂ ਅੱਡ ਅੱਡ ਤਰ੍ਹਾਂ ਦੇ ਫਲਾਵਰ ਜਾਂ ਫਿਰ ਕਹਿ ਲਓ ਦੂਜੇ ਪਲਾਂਟ 'ਚ ਵੀ ਆਪਾਂ ਅੱਡ ਅੱਡ ਸੀਜ਼ਨ 'ਚ ਲਾ ਸਕਦੇ ਹਾਂ ਅੱਡ ਅੱਡ ਰੁੱਤ 'ਚ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਆਪਣੇ ਭਿੰਡੀਆਂ ਉਗਾ ਸਕਦੇ ਹਾਂ ਸੂਰਜਮੁਖੀ ਦੀ ਖੇਤੀ ਕਰ ਸਕਦੇ ਹਾਂ ਫਿਰ ਆਪਾਂ ਲੌਕੀ ਕੱਦੂ ਤੋਰੀਆਂ ਇਹ ਸਾਰੇ ਉਗਾ ਸਕਦੇ ਮਿਰਚਾਂ ਅਤੇ ਵੀ ਉਗਾ ਸਕਦੇ ਹਾਂ ਅਸੀਂ ਅੱਡ ਅੱਡ ਫੁੱਲ ਜਿਹੜੇ ਕਿ ਇੱਕ ਜੇਡ ਪਲਾਂਟ ਹੁੰਦਾ ਉਹ ਵੀ ਗਰਮੀਆਂ 'ਚ ਬਹੁਤ ਵਧੀਆ ਖਿਲ ਕੇ ਆਉਂਦਾ ਉਹ ਪਲਾਂਟ ਬਾਕੀ ਜੇ ਆਪਾਂ ਪੱਤਝੜ ਦੇ ਮੌਸਮ 'ਚ ਵੇਖੀਏ ਤਾਂ ਮੂਲੀਆਂ ਚਲ ਗਾਵਾਂ ਫਿਰ ਫੁੱਲਾਂ ਵਾਲੇ ਪੌਦੇ ਵੀ ਹੁੰਦੇ ਆ ਗੁਲਦਾਉਦੀ ਜਿਹੜੇ ਹੁਣ ਸ਼ੁਰੂ ਹੋ ਜਾਂਦੇ ਆ ਖੀਰੇ ਬਾਕੀ ਤੋ ਆਪਣਾ ਗਾਜਰ ਇਹ ਸਾਰੀਆਂ ਆਪਾਂ ਪੱਤਝੜ ਦੇ ਮੌਸਮ 'ਚ ਹਿਲਾ ਕੇ ਸ਼ੁਰੂ ਕਰ ਸਕਦੇ ਹਾਂ ਅਤੇ ਹੁਣ ਜਿਵੇਂ ਸਰਦੀ ਸ਼ੁਰੂ ਹੋਣ ਵਾਲੀ ਉਹਦੇ 'ਚ ਆਪਾਂ ਸਰ੍ਹੋਂ ਉਗਾ ਸਕਦੇ ਹਾਂ ਅਤੇ ਪਾਲਕ ਉਗਾ ਸਕਦੇ ਹਾਂ ਜਿਹੜੇ ਕਿ ਬਹੁਤ ਵਧੀਆ ਹੁੰਦੇ ਆਪਣੇ ਹੈਲਥ ਲਈ ਅਤੇ ਆਪਾਂ ਪੱਤਾ ਗੋਭੀ ਵੀ ਉਗਾ ਸਕਦੇ ਹਾਂ ਅਤੇ ਫੁੱਲਾਂ ਵਾਲੇ ਵੀ ਬਹੁਤ ਸੋਹਣੇ ਪੌਦੇ ਹੁੰਦੇ ਜਿਹੜੇ ਆਪਾਂ ਉਗਾ ਸਕਦੇ ਹਾਂ ਜਿਵੇਂ ਕਿ ਪਟੁਮੀਆ ਹੋ ਗਿਆ ਅਤੇ ਹੋਰ ਆਪਾਂ ਲਾ ਸਕਦੇ ਹਾਂ ਅੱਡ ਅੱਡ ਪ੍ਰਕਾਰ ਦੇ ਲਗਾ ਸਕਦੇ ਹਾਂ ਅਤੇ ਜੇ ਆਪਾਂ ਭੀੜ ਜਿਵੇਂ ਆਪਾਂ ਬੋਹੜ ਹੋ ਗਿਆ ਅਤੇ ਹੋਰ ਵੀ ਬਥੇਰੇ ਹੈਗੇ ਆ ਜਿਹੜੇ ਲਾ ਸਕਦੇ ਹਾਂ ਬਾਕੀ ਹਾਂਜੀ ਅਤੇ ਪਿੱਪਲ ਹਾਂਜੀ ਹਾਂਜੀ ਜਾਮਣ ਜਾਮਣ ਆਪਾਂ ਗਰਮੀਆਂ 'ਚ ਆਪਾਂ ਨੂੰ ਜਾਮਨ ਗਰਮੀਆਂ 'ਚ ਮਿਲਦੇ ਆਪਾਂ ਨੂੰ ਬਾਕੀ ਆਪਾਂ ਉਹ ਐਵਰ ਗਰੀਨ ਹੁੰਦੇ ਬਾਕੀ ਤਾਂ ਆਪਾਂ ਕਦੋਂ ਮਰਜ਼ੀ ਲਗਾ ਸਕਦੇ ਹਾਂ ਹਾਂਜੀ ਉਹਦੇ ਨਾਲ ਬੱਸ ਹਾਂਜੀ ਹਾਂਜੀ ਬਾਕੀ ਜੇ ਆਪਾਂ ਮ ਮੌਨਸੂਨ 'ਚ ਲਗਾਉਣੇ ਆ ਫਿਰ ਆਪਾਂ ਚੌਲਾਂ ਦੀ ਕਰ ਸਕਦੇ ਖੇਤੀ ਮੱਕੀ ਦੀ ਕਰ ਸਕਦੇ ਹਾਂ ਹੈ ਨਾ ਬਾਕੀ ਆਪਾਂ ਜਿਵੇਂ ਹਾਂਜੀ ਹਾਂਜੀ ਜਿਵੇਂ ਆਪਾਂ ਠੰਡ ਠੰਡ ਸਰਦੀਆਂ ਦੇ ਵਿੱਚ ਸਾਗ ਬਣਾਉਂਦੇ ਆ ਉਹਦੇ ਵਿੱਚ ਵੀ ਆਪਾਂ ਨੂੰ ਕਾਫੀ ਤਰ੍ਹਾਂ ਦੀਆਂ ਆਪਾਂ ਹਰੀਆਂ ਸਬਜ਼ੀਆਂ ਪਾਉਦੇ ਹਾਂ ਉਹਦੇ ਵਿੱਚ ਆਪਾਂ ਮੇਥੀ ਵੀ ਉਗਾ ਸਕਦੇ ਹਾਂ ਹੈ ਨਾ ਜੀ ਬਾਕੀ ਆਪਾਂ ਸ਼ਲ ਆਪਣਾ ਸ਼ਲਗਮ ਉਗਾ ਸਕਦੇ ਹੁਣੇ ਜਿਵੇਂ ਸਰਦੀਆਂ ਦਾ ਮੌਸਮ ਆ ਰਿਹਾ ਚੁਕੰਦਰ ਉਗਾ ਸਕਦੇ ਜਿਹਦੇ ਨਾਲ ਆਪਾਂ ਜੂਸ ਬਣਾ ਕੇ ਪੀ ਸਕਦੇ ਅਨਾਰਾਂ ਦੇ ਪੌਦੇ ਲਗਾ ਸਕਦੇ ਹਾਂ ਇੱਦਾਂ ਵੱਖ ਵੱਖ ਵੱਖ ਤਰ੍ਹਾਂ ਦੇ ਲਗਾ ਸਕਦੇ ਹਾਂ

ਹਾਂ ਹਾਂਜੀ ਹਾਂਜੀ ਸਰ੍ਹੌਂ ਵੀ ਹੁਣ ਆਪਾਂ ਲਗਾ ਸਕਦੇ ਹਾਂ ਹੁਣ ਸਹੀ ਹਾਂਜੀ ਆਲੂ ਦੀ ਖੇਤੀ ਵੀ ਅਸੀਂ ਹੁਣੇ ਕਰ ਸਕਦੇ ਹਾਂ ਹੁਣੇ ਸਭ ਤੋਂ ਵਧੀਆ ਮੌਸਮ ਆ ਨਾ ਜ਼ਿਆਦਾ ਗਰਮੀ ਆ ਨਾ ਜ਼ਿਆਦਾ ਠੰਡ ਹੁਣੇ ਸਭ ਤੋਂ ਬੈਸਟ ਮੌਸਮ ਆਲੂ ਵੀ ਲਗਾਉਣਾ ਹਾਂਜੀ ਹਾਂਜੀ ਠੀਕ ਆ ਜੀ ਠੀਕ ਹੈ ਧੰਨਵਾਦ ਜੀ ਧੰਨ